ਮੈਨੂੰ ਸਟੈਂਪ ਅਤੇ ਸਿੱਕੇ ਇਕੱਠੇ ਕਰਨ ਵਿੱਚ ਬਹੁਤ ਦਿਲਚਸਪੀ ਹੈ ਸਟੈਂਪ ਨੂੰ ਇਕੱਠੇ ਕਰਨ ਨਾਲ ਸਾਡੇ ਗਿਆਨ ਇਕੱਠਾ ਕਰਨ ਵਿੱਚ ਵੀ ਵਾਧਾ ਹੁੰਦਾ ਹੈ ਅਲੱਗ ਅਲੱਗ ਸਟੈਂਪਾਂ ਸਾਨੂੰ ਹਰ ਤਰ੍ਹਾਂ ਦਾ ਅਲੱਗ ਗਿਆਨ ਦਿੰਦੀਆਂ ਨੇ ਮੈਂ ਇਕੱਠੀ ਕੀਤੀਆਂ ਸਟੈਂਪਾਂ ਨੂੰ ਇੱਕ ਵੱਡੀ ਐਲਬਮ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਮੇਰੀਆਂ ਇਕੱਠੀਆਂ ਕੀਤੀਆਂ ਸਟੈਂਪਾਂ ਕੁਝ ਇੱਦਾਂ ਦੀਆਂ ਨੇ ਕਈਆਂ ਵਿੱਚ ਪੰਛੀ ਬਣੇ ਹੋਏ ਨੇ ਮੋਰ ਬਣੇ ਹੋਏ ਨੇ ਕਈਆਂ ਵਿੱਚ ਮਛਲੀ ਬਣੀ ਹੋਈ ਹੈ ਅਤੇ ਕਈਆਂ ਵਿੱਚ ਬੰਦਿਆਂ ਦੀ ਤਸਵੀਰਾਂ ਬਣੀ ਹੁੰਦੀਆਂ ਨੇ ਮੈਨੂੰ ਸਿੱਕੇ ਇਕੱਠੇ ਕਰਨ ਦਾ ਵੀ ਬਹੁਤ ਸ਼ੌਕ ਹੈ ਅਲੱਗ ਅਲੱਗ ਵਿਦੇਸ਼ਾਂ ਤੋਂ ਆਏ ਸਿੱਕੇ ਇਕੱਠੇ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਇਹਨਾਂ ਨਾਲ ਵੀ ਸਾਡੀ ਕਈ ਯਾਦਾਂ ਜੁੜੀਆਂ ਹੁੰਦੀਆਂ ਨੇ ਇਹ ਸਾਨੂੰ ਵਿਦੇਸ਼ਾਂ ਦੀ ਨਿਸ਼ਾਨੀ ਬਾਰੇ ਦਰਸਾਉਂਦੇ ਨੇ